ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਕੋਲਜ ਸਕੂਲਾਂ ਵਿੱਚ ਬੱਚਿਆਂ ਵਾਸਤੇ ਹਰ ਜਗ੍ਹਾ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਸਕੋਲਰਸ਼ਿਪਾਂ ਹਨ ਜਿਵੇਂ ਕਿ ਪੀ ਪੀ ਐੱਸ ਦੀ ਇੱਕ ਲ ਸਕੋਲਰਸ਼ਿਪ ਹੈ ਐਸ ਸੀ ਕੋਟੀ ਦੀ ਸਕੋਲਰਸ਼ਿਪ ਹੈ ਅਤੇ ਖੇਡਾਂ ਵਿਭਾਗ ਵਿੱਚ ਵੀ ਬੱਚਿਆਂ ਨੂੰ ਬਹੁਤ ਸਾਰੇ ਸਕੋਲਰਸ਼ਿਪਾਂ ਮਿਲਦੀਆਂ ਹਨ ਜਿਹਨਾਂ ਨਾਲ ਉਹਨਾਂ ਦੀ ਅੱਧੀ ਫੀਸ ਮਾਫ ਹੋ ਜਾਂਦੀ ਹੈ ਅਤੇ ਉਹਨਾਂ ਦੀ ਸਾਰੀ ਫੀਸ ਵੀ ਮਾਫ ਹੋ ਜਾਂਦੀ ਹੈ ਬੱਚਿਆਂ ਵਾਸਤੇ ਬਹੁਤ ਤਰ੍ਹਾਂ ਦੇ ਇਮਤਿਹਾਨ ਰੱਖੇ ਜਾਂਦੇ ਹਨ ਜਿਹਨਾਂ ਵਿੱਚੋਂ ਉਹ ਵਧੀਆ ਪੜ੍ਹ ਕੇ ਅਤੇ ਵਧੀਆ ਨੰਬਰ ਲੈ ਕੇ ਆਪਣੀ ਫੀਸਾਂ ਮਾਫ ਕਰ ਦਿੰਦੇ ਹਨ ਉਹਨਾਂ ਨੂੰ ਪੈਸੇ ਵੀ ਮਿਲਦੇ ਹਨ ਇਸ ਤਰ੍ਹਾਂ ਹੀ ਲੜਕੀਆਂ ਵਾਸਤੇ ਵੀ ਬਹੁਤ ਸਾਰੀਆਂ ਯੋਜਨਾਵਾਂ ਅਤੇ ਸਕੀਮਾਂ ਰੱਖੀਆਂ ਗਈਆਂ ਹਨ ਜਿਹਨਾਂ ਨਾਲ ਉਹ ਅੱਗੇ ਵੱਧ ਸਕਦੀਆਂ ਹਨ ਪਿੱਛੇ ਹੀ ਲੜਕੀਆਂ ਨੂੰ ਉਹ ਮੋਬਾਇਲ ਦਿੱਤੇ ਗਏ ਕਿ ਉਹ ਕਿਉਂਕਿ ਉਸ ਸਮੇਂ ਵਿੱਚ ਕੋਵਿਡ ਕਰਕੇ ਹਰ ਸਕੂਲ ਕੋਲੇਜ ਬੰਦ ਹੋ ਗਿਆ ਸੀ ਅਤੇ ਲੜਕੀਆਂ ਨੂੰ ਮੁਸੀਬਤਾਂ ਮੁਸ਼ਕਿਲ ਆਉਂਦੀ ਸੀ ਪੜ੍ਹਨ ਦੇ ਵਿੱਚ ਅਤੇ ਔਨਲਾਈਨ ਕਲਾਸਾਂ ਹੋਣ ਕਰਕੇ ਉਹਨਾਂ ਨੂੰ ਸਰਕਾਰ ਵੱਲੋਂ ਗਰੀਬ ਘਰਾਂ ਨੂੰ ਮੋਬਾਇਲ ਦਿੱਤੇ ਗਏ ਅਤੇ ਹਾਂ ਉਹਨਾਂ ਨੂੰ ਲੈਪਟੋਪ ਵੀ ਦਿੱਤੇ ਗਏ ਉਹਨਾਂ ਨੂੰ ਸਾਈਕਲ ਵੀ ਦਿੱਤੇ ਗਏ ਅਤੇ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਰੱਖੀਆਂ ਗਈਆਂ ਜਿਹਨਾਂ ਨਾਲ ਵਿਦਿਆਰਥੀ ਆਪਣੇ ਅੱਗੇ ਵੱਧ ਸਕਦੇ ਹਨ ਇਸ ਤਰ੍ਹਾਂ ਹੀ ਉਹਨਾਂ ਲਈ ਹਰ ਜਗ੍ਹਾ ਦੇ ਵਿੱਚ ਬਹੁਤ ਸਾਰੀਆਂ ਸਕੋਲਰਸ਼ਿਪਾਂ ਅਤੇ ਸਕੀਮਾਂ ਬਣਾਈਆਂ ਜਾਂਦੀਆਂ ਹਨ ਜਿਹਨਾਂ ਨਾਲ ਉਹ ਆਪਣੇ ਦੇਸ਼ ਅਤੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰ ਸਕਦੇ ਹਨ ਉਹਨਾਂ ਨੂੰ ਦੂਰੋਂ ਦੂਰੋਂ ਟੈਸਟ ਵੀ ਆਉਂਦੇ ਹਨ ਅਤੇ ਉਹਨਾਂ ਦੇ ਨਾਲ ਉਹ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਵੀ ਆਪਣੇ ਦੇਸ਼ ਦਾ ਨਾਂ ਆਪਣੇ ਦੇਸ਼ ਨੂੰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੀਆਂ ਹਨ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਟੈਸਟ ਅਤੇ ਯੋਜਨਾਵਾਂ ਦੇ ਕੇ ਉਹਨਾਂ ਵਾਸਤੇ ਇੱਕ ਨਵੇਂ ਰਸਤੇ ਖੋਲ੍ਹੇ ਜਾਂਦੇ ਹਨ ਸਰਕਾਰ ਵੱਲੋਂ